ਜਿਵੇਂ ਕਿ ਮੇਰੇ ਘਰ ਦੇ ਬਜ਼ੁਰਗਾਂ ਨੂੰ ਰੇਡੀਓ ਸੁਣਨਾ ਬਹੁਤ ਪਸੰਦ ਸੀ ਪਰ ਮੈਨੂੰ ਟੀ ਵੀ ਦੇਖਣਾ ਸਭ ਤੋਂ ਜ਼ਿਆਦਾ ਪਸੰਦ ਹੈ ਅਤੇ ਟੀ ਵੀ 'ਤੇ ਵੈਸੇ ਤਾਂ ਮੈਨੂੰ ਬਹੁਤ ਜ਼ਿਆਦਾ ਪ੍ਰੋਗਰਾਮ ਸਾਰੇ ਵਧੀਆ ਲੱਗਦੇ ਨੇ ਪਰ ਮੈਨੂੰ ਪੰਜਾਬੀ 'ਚ ਇੱਕ ਆਉਂਦਾ ਹੁੰਦਾ ਸੀ ਪ੍ਰੋਗਰਾਮ ਦਿਲ ਦੀਆਂ ਗੱਲਾਂ ਮੈਨੂੰ ਉਹ ਦੇਖਣਾ ਬਹੁਤ ਪਸੰਦ ਸੀ ਉਹ ਆਏ ਸੰਡੇ ਆਉਂਦਾ ਸੀਗਾ ਅਤੇ ਉਹਦੀ ਟਾਈਮਿੰਗ ਸੀਗੀ ਨੌਂ ਤੋਂ ਲੈ ਕੇ ਦਸ ਵਜੇ ਤੱਕ ਉਸ ਵਿੱਚ ਦੋ ਪਰਸਨ ਹੁੰਦੇ ਸੀਗੇ ਜੋ ਆਪਸ 'ਚ ਡਿਸਕਸ਼ਨ ਕਰਦੇ ਸੀਗੇ ਇੱਕ ਮੁੱਦੇ ਉੱਤੇ ਅਤੇ ਉਹ ਕਾਫੀ ਜਿਵੇਂ ਆਪਣੀ ਪੇਂਡੂ ਆਪਣੀ ਨਿੱਜੀ ਗੱਲਾਂ ਵੀ ਸ਼ੇਅਰ ਕਰਦੇ ਸੀ ਉਸ ਵਿੱਚ ਤਾਂ ਉਹ ਸੁਣਨਾ ਮੈਨੂੰ ਬਹੁਤ ਪਸੰਦ ਸੀ ਜਿਹਦੇ ਨਾਲ ਮੇਰਾ ਗਿਆਨ 'ਚ ਵੀ ਵਾਧਾ ਹੁੰਦਾ ਸੀ ਅਤੇ ਕੁਛ ਉਹਦੇ 'ਚ ਜਿਵੇਂ ਜਨਰਲ ਨੌਲੇਜ ਦੀਆਂ ਵੀ ਉਹ ਕਾਫੀ ਗੱਲਾਂ ਸ਼ੇਅਰ ਕਰਦੇ ਸੀਗੇ ਅਤੇ ਉਹ ਆਏ ਹਫਤੇ ਇੱਕ ਉਹ ਨਵੇਂ ਪਰਸਨ ਨੂੰ ਹੀ ਇਨਵਾਈਟ ਕਰਦੇ ਸੀ ਉੱਥੇ ਉਹ ਡਿਸਕਸ਼ਨ ਲਈ ਕੁਛ ਆਪਣੀਆਂ ਗੱਲਾਂ ਸਾਂਝੀਆਂ ਕਰਨ ਲਈ ਤੋ ਆਪਣੀ ਸਾਰੀ ਜਿੰਨੀ ਵੀ ਉਹ ਉਹਦੇ ਨਾਲ ਬੀਤੀ ਹੁੰਦੀ ਉਹ ਚੀਜ਼ ਵੀ ਡਿਸਕਸ ਕਰਦਾ ਸੀ ਅਤੇ ਆਉਣ ਵਾਲੀਆਂ ਭਵਿੱਖ 'ਚ ਜੋ ਚੇਂਜ ਉਸ ਦੇ ਰਿਲੇਟਿਡ ਹੁੰਦਾ ਸੀ ਉਸ ਦੇ ਨਾਲ ਵੀ ਉਹ ਸ਼ੇਅਰ ਕਰਦਾ ਸੀ